ਸਰਕਾਰ ਵੱਲੋਂ ਜਿਹੜੇ ਆਪਾਂ ਨੂੰ ਪਾਣੀ ਦੀ ਸਹੂਲਤ ਦਿੱਤੀ ਜਾਂਦੀ ਹੈ ਜਿਵੇਂ ਪਾਣੀ ਦੀ ਸਪਲਾਈ ਹੁੰਦੀ ਹੈ ਘਰ ਘਰ ਟੂਟੀਆਂ ਲੱਗੀਆਂ ਹੋਈਆਂ ਉਹ ਪਾਣੀ ਬਹੁਤ ਅੱਛਾ ਹੁੰਦਾ ਔਰ ਪੀਣੇ ਵਿੱਚ ਵੀ ਬਹੁਤ ਠੀਕ ਹੁੰਦਾ ਸਾਡੇ ਇੱਥੇ ਦੋ ਟਾਈਮ ਪਾਣੀ ਛੱਡਦੇ ਆ ਟੂਟੀਆਂ ਦਾ ਪਾਣੀ ਔਰ ਸ਼ਾਮ ਨੂੰ ਵੀ ਦੋ ਘੰਟੇ ਆਉਂਦਾ ਹੈ ਔਰ ਸਵੇਰੇ ਵੀ ਇਸ ਨਾਲ ਅਸੀਂ ਬਹੁਤ ਸਾਰੇ ਕੰਮ ਆਪਣੇ ਪਾਣੀਆਂ ਵਾਲੇ ਕਰ ਸਕਦੇ ਜਿਵੇਂ ਉਸੇ ਟਾਈਮ ਲੇਡੀਜ਼ ਕੱਪੜੇ ਧੋ ਲੈਦੀਆਂ ਜਾਂ ਹੋਰ ਜਿਹੜੇ ਵੀ ਆਪਣੇ ਪਾਣੀ ਦੇ ਨਾਲ ਕੰਮ ਹੁੰਦੇ ਆ ਉਹ ਕਰ ਲੈਂਦੇ ਹਾਂ ਔਰ ਇਹਦੇ ਨਾਲ਼ ਬਹੁਤ ਜ਼ਿਆਦਾ ਸਹੂਲਤ ਹੋ ਗਈ ਔਰ ਪਾਣੀ ਬਹੁਤ ਜ਼ਿਆਦਾ ਸਾਫ ਹੁੰਦਾ ਔਰ ਪੀ ਵੀ ਸਕਦੇ ਹਾਂ ਔਰ ਸਾਰੇ ਕੰਮ ਇਹਦੇ ਨਾਲ ਘਰ ਦੇ ਤੇ ਠੀਕ ਕਰ ਸਕਦੇ ਆਪਾਂ